ਸਾਡੇ ਖੇਤਰ ਵਿੱਚ ਅਪਰਾਧ ਅਤੇ ਦੁਰਘਟਨਾਵਾਂ ਨੂੰ ਕੰਟਰੋਲ ਕਰਨ ਲਈ ਪੁਲਿਸ ਕਰਮੀ ਬਹੁਤ ਬਾਖੂਬੀ ਢੰਗ ਨਾਲ ਆਪਣੀ ਸੇਵਾ ਨਿਭਾ ਰਹੇ ਹਨ ਉਹ ਅਪਰਾਧ ਅਤੇ ਦ ਦੁਰਘਟਨਾਵਾਂ ਨੂੰ ਰੋਕਣ ਲਈ ਦਿਨ ਰਾਤ ਮਿਹਨਤ ਕਰਦੇ ਹਨ ਉਹ ਅਪਰਾਧ ਜਿਵੇਂ ਕਿ ਸ਼ਰਾਬ ਅਤੇ ਹੋਰ ਕਈ ਪ੍ਰਕਾਰ ਦੇ ਨਸ਼ਿਆਂ ਆਦਿ ਨੂੰ ਘਟਾਉਣ ਲਈ ਦਿਨ ਰਾਤ ਆਪਣੀ ਡਿਊਟੀ ਨਿਭਾਉਂਦੇ ਹਨ ਅਤੇ ਸੰਬੰਧਿਤ ਵਿਅਕਤੀਆਂ ਦੀ ਜਾਂਚ ਕਰਦੇ ਹਨ ਉਹ ਅਪਰਾਧਾਂ ਨੂੰ ਜਿਵੇਂ ਕਿ ਬਲਾਤਕਾਰ ਵਰਗੇ ਜਾਂ ਹੋਰ ਬੱਚਿਆਂ ਨਾਲ ਹੋਣ ਵਾਲੇ ਅਨਿਆਂ ਵਰਗੇ ਬਲਾਤਕਰ ਅਤੇ ਹੋਰ ਕਈ ਤਰ੍ਹਾਂ ਦੇ ਅਪਰਾਧਾਂ ਦੀ ਵੀ ਦੇਖਦੇ ਹਨ ਅਤੇ ਉਹਨਾਂ 'ਤੇ ਕ ਕਾਨੂੰਨੀ ਕਾਰਵਾਈ ਕਰਦੇ ਹਨ ਉਹ ਦੁਰਘਟਨਾਵਾਂ ਨੂੰ ਰੋਕਣ ਲਈ ਟ੍ਰੈਫਿਕ ਪੁਲਿਸ ਦੀ ਸਹਾਇਤਾ ਨਾਲ ਚੰਗੀ ਤਰ੍ਹਾਂ ਟ੍ਰੈਫਿਕ ਨੂੰ ਸੰਭਾਲਦੇ ਹਨ ਅਤੇ ਆਪਣੇ ਅਤੇ ਨਾਗਰਿਕਾਂ ਨੂੰ ਟ੍ਰੈਫਿਕ ਰੂਲਜ ਸਮਝਾਉਂਦੇ ਹਨ ਉਹ ਹਫ਼ਤਾਵਾਰੀ ਕੈਂਪ ਵੀ ਲਗਾ ਰਹੇ ਹਨ ਜਿਸ ਨਾਲ ਕਿ ਆਮ ਜ ਨਾਗਰਿਕਾਂ ਨੂੰ ਟ੍ਰੈਫਿਕ ਰੂਲ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਜੋ ਉਹ ਸੜਕ 'ਤੇ ਡਰਾਈਵਿੰਗ ਕਰਦੇ ਸਾ ਸਮੇਂ ਕਿਸੇ ਦੁਰਘਟਨਾ ਦਾ ਸ਼ਿਕਾਰ ਨਾ ਹੋਣ ਅਤੇ ਇਹਨਾਂ ਇਸ ਨਾਲ ਦੁਰਘਟਨਾਵਾਂ ਹੋਣ ਦੇ ਕਾਰਨ ਘੱਟ ਜਾਂਦੇ ਹਨ ਅਤੇ ਸੁਰੱਖ ਅਤੇ ਟ੍ਰੈਫਿਕ ਵਿੱਚ ਸੁਧਾਰ ਆਉਂਦਾ ਹੈ ਜਿਸ ਨਾਲ ਕਈ ਵਿਅਕਤੀਆਂ ਦੀ ਜਾਨ ਬਚ ਜਾਂਦੀ ਹੈ ਸਰਦੀਆਂ ਨੇ ਮੌਸਮ ਵਿੱਚ ਧੁੰਦ ਕਾਰਨ ਬਹੁਤ ਸਾਰੀਆਂ ਦੁਰਘਟਨਾਵਾਂ ਹੋ ਜਾਂਦੀਆਂ ਹਨ ਇਹਨਾਂ ਲਈ ਉਹ ਸਮੇਂ ਸਮੇਂ 'ਤੇ ਡਿਊਟੀਆਂ ਲਗਾਉਂਦੇ ਹਨ ਅਤੇ ਧੁੰਦ ਵਿੱਚ ਚੱਲਣ ਵਾਲੇ ਡਰਾਈਵਰਾਂ ਨੂੰ ਸੰਕੇਤ ਦਿੰਦੇ ਰਹਿੰਦੇ ਹਨ ਜਿਸ ਨਾਲ ਉਹ ਉਜ ਉਜਾਗਰ ਹੋ ਜਾਂਦੇ ਹਨ ਅਤੇ ਕਿਸੇ ਵੀ ਦੁਰਘਟਨਾ ਨੂੰ ਹੋਣ ਤੋਂ ਪਹਿਲਾਂ ਉਸ ਬਾਰੇ ਜਾਣ ਲੈਂਦੇ ਹਨ ਅਤੇ ਨਾਲ ਹੀ ਆਮ ਨਾਗਰਿਕਾਂ ਨੂੰ ਇਸ ਬਾਰੇ ਦੱਸਿਆ ਜਾਂਦਾ ਹੈ ਕਿ ਉਹ ਆਪਣੀ ਸੁਰੱਖਿਆ ਕਿੰਝ ਕਰ ਸਕਦੇ ਹਨ ਅਤੇ ਜੇਕਰ ਕਿਸੀ ਹੋਰ ਨੂੰ ਵੀ ਕਿਸੀ ਮਦਦ ਦੀ ਜ਼ਰੂਰਤ ਹੈ ਤਾਂ ਉਹ ਉਹਨਾਂ ਦੀ ਸਹਾਇਤਾ ਕਿਵੇਂ ਕਰ ਸਕਦੇ ਹਨ ਉਹ ਆਪਣੇ ਪ੍ਰੋਗਰਾਮ ਲਗਾਉਂਦੇ ਹਨ ਜਿਸ ਵਿੱਚ ਕਈ ਪ੍ਰੋਫੈਸ਼ਨਲ ਔਫੀਸਰਸ ਵੀ ਆਉਂਦੇ ਹਨ ਅਤੇ ਉਹ ਆਮ ਜਨਤਾ ਨਾਲ ਦੇ ਰੂਬਰੂ ਹੋ ਕੇ ਉਹਨਾਂ ਨੂੰ ਬਹੁਤ ਵਧੀਆ ਢੰਗ ਨਾਲ ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੰਦੇ ਹਨ ਅਤੇ ਬੱਚਿਆਂ ਨੂੰ ਵੀ ਉਹ ਇਹਨਾਂ ਨਿਯਮਾਂ ਦੀ ਜਾਣਕਾਰੀ ਦਿੰਦੇ ਹਨ ਅਤੇ ਰ ਰੂਲ ਵੀ ਸਮਝਾਉਂਦੇ ਹਨ ਅਪਰਾਧ ਕਈ ਪ੍ਰਕਾਰ ਦੇ ਹਨ ਜਿਵੇਂ ਕਿ ਅੱਜ ਦੇ ਸਮੇਂ ਵਿੱਚ ਨਸ਼ੇ ਬਹੁਤ ਵੱਧ ਰਹੇ ਹਨ ਇਸ ਲਈ ਉਹ ਨਸ਼ਿਆਂ ਨੂੰ ਰੋਕਣ ਲਈ ਦਿਨ ਵਿੱਚ ਦੋ ਰਾਊਂਡ ਲਗਾਉਂਦੇ ਹਨ ਤਾਂ ਜੋ ਕੋਈ ਵਿਅਕਤੀ ਜਿਸ 'ਤੇ ਸ਼ੱਕ ਦੀ ਉਮੀਦ ਹੈ ਉਸਦੀ ਤਲਾਸ਼ੀ ਲਈ ਜਾ ਸਕੇ ਉਹ ਰਿਹਾਇਸ਼ ਦੇ ਨੇੜਲੇ ਖੇਤਰਾਂ ਵਿੱਚ ਜਾ ਕੇ ਚੈਕਿੰਗ ਕਰਦੇ ਹਨ ਅਤੇ ਉਹਨਾਂ ਨੇ ਕਈ ਥਾਵਾਂ ਉੱਤੇ ਸੀ ਸੀ ਟੀ ਵੀ ਕੈਮਰੇ ਵੀ ਲਗਾਏ ਹੋਏ ਹਨ ਤਾਂ ਜੋ ਕੋਈ ਵੀ ਅਪਰਾਧ ਹੁੰਦਾ ਹੈ ਤਾਂ ਉਹਨਾਂ ਦੀ ਫੁਟੇਜ ਉਹਨਾਂ ਨੂੰ ਸਮੇਂ ਸਿਰ ਮਿਲ ਸਕੇ ਅਤੇ ਉਹ ਸਮੇਂ ਸਿਰ ਆਪਣੀ ਕਾਰਵਾਈ ਕਰ ਸਕਣ ਧੰਨਵਾਦ